ਹੈਲੋ ਰੋਇਲ ਰੈਸਟੋਰੈਂਟ ਮੈਂ ਹਰਪ੍ਰੀਤ ਪਿੰਡ ਫਫੜੇ ਭਾਈਕੇ ਤੋਂ ਮੈਂ ਇੱਕ ਘੰਟਾ ਪਹਿਲਾਂ ਆਰਡਰ ਕੀਤਾ ਸੀ ਮੈਂ ਹਰ ਵਾਰ ਤੁਹਾਡੇ ਹੀ ਭੋ ਤੁਹਾਡੇ ਰੈਸਟੋਰੈਂਟ ਤੋਂ ਭੋਜਨ ਮੰਗਵਾਉਂਦੀ ਹਾਂ ਮੈਨੂੰ ਰੈਸਟੋਰੈਂਟ ਦੀ ਸਰਵਿਸ ਬਹੁਤ ਪਸੰਦ ਹੈ ਅਤੇ ਬਹੁਤ ਟੇਸਟੀ ਹੁੰਦਾ ਤੁਹਾਡੇ ਰੈਸਟੋਰੈਂਟ ਦਾ ਖਾਣਾ ਸਾਡੇ ਘਰ ਘੰਟੇ ਇੱਕ ਘੰਟੇ ਵਿੱਚ ਰਿਸ਼ਤੇਦਾਰਾਂ ਨੇ ਆਉਣਾ ਹੈ ਮੈਂ ਉਹਨਾਂ ਲਈ ਰੋਟੀ ਸਬਜ਼ੀ ਚਾਵਲ ਮਿੱਠੇ ਵਿੱਚ ਗੁਲਾਬ ਜਾਮਣ ਬਰਫੀ ਅਤੇ ਉਹ ਹੋਰ ਕੋਲਡ ਰਿੰਕ ਆਦਿ ਆਰਡਰ ਕੀਤਾ ਹੈ ਇਹ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਮੇਰਾ ਆਰਡਰ ਕਦੋਂ ਤੱਕ ਡਲੀਵਰ ਕਰੋਗੇ ਮੈਂ ਆਪਣਾ ਐਡਰੈਸ ਤੁਹਾਨੂੰ ਸੈਂਡ ਕਰ ਦਿੱਤਾ ਹੈਗਾ ਮੇਰਾ ਆਰਡਰ ਫਫੜੇ ਭਾਈਕੇ ਪਿੰਡ ਵਿੱਚ ਸ਼ਿਵ ਮੰਦਿਰ ਕੋਲ ਪਹੁੰਚਾਉਣ ਦੀ ਕਿਰਪਾਲਤਾ ਕਰਨੀ ਨਾਲ ਤੁਸੀਂ ਟਿਸ਼ੂ ਪੇਪਰ ਜਾਂ ਕੋਲਡ ਡਰਿੰਕ ਇਹ ਨਾਲ ਹੋਰ ਵੀ ਕੁਝ ਭੇਜਣ ਦੀ ਕਿਰਪਾਲਤਾ ਕਰਨੀ ਵਧੀਆ ਸਰਵਿਸ ਹੋਵੇ ਵਧੀਆ ਤਰੀਕੇ ਨਾਲ ਪੈਕਿੰਗ ਕੀਤੀ ਹੋਵੇ ਤੁਸੀਂ ਕੋਸ਼ਿਸ਼ ਕਰੋ ਕਿ ਮੇਰਾ ਆਰਡਰ ਜਲਦੀ ਤੋਂ ਜਲਦੀ ਇੱਕ ਘੰਟੇ ਦੇ ਵਿੱਚ ਸਾਡੇ ਘਰ ਕੋਲ ਸ਼ਿਵ ਮੰਦਿਰ ਕੋਲ ਪਹੁੰਚਾਇਆ ਜਾਵੇ ਤਾਂ ਕਿ ਮੈਂ ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਆਪਣਾ ਆਰਡਰ ਪਹੁੰਚਾ ਸਕਾਂ ਸਾਡੇ ਪਿੰਡ ਆ ਕੇ ਫੋਨ ਕਰ ਲਓ ਕਰ ਦਿਓ ਸਾਨੂੰ ਮੈਂ ਸ਼ਿਵ ਮੰਦਿਰ ਕੋਲ ਆ ਕੇ ਆਰਡਰ ਲੈ ਜਾਵਾਂਗੀ ਇਸ ਲਈ ਧੰਨਵਾਦ